ਮੈਂ ਅਬ ਆਖਰੀ ਸਮੇਂ ਦੇ ਵਿੱਚ ਫੇਸਬੁੱਕ ਐਪ ਡਾਊਨਲੋਡ ਕੀਤੀ ਜਿਸ ਦੇ ਨਾਲ ਮੈਂ ਆਪਣੇ ਸਮਾਜ ਦੇ ਨਾਲ ਜੁੜਿਆ ਰਹਿੰਦਾ ਹਾਂ ਅਤੇ ਇਹਦੇ ਵਿੱਚ ਸਮਾਜ ਦੀ ਹਰ ਗਤੀਵਿਧੀ ਦਾ ਤਕਰੀਬਨ ਪਤਾ ਲੱਗਦਾ ਰਹਿੰਦਾ ਹੈ ਧੰਨਵਾਦ